ਮੈਂ ਵਿਜੈ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਦੌਰ ਵਿੱਚ ਜਿਹੜੀਆਂ ਵੀ ਚੋਣਾਂ ਹੁੰਦੀਆਂ ਹਨ ਉਹਨਾਂ ਵਿੱਚ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਕਾ ਜਿਨ੍ਹਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਲੱਗ ਜਾਂਦੀਆਂ ਹਨ ਉਹਨਾਂ ਨੂੰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਭਾਵ ਜਿਹੜੇ ਮੁਲਾਜ਼ਮਾਂ ਦੀਆਂ ਡਿਊਟੀਆਂ ਜਾਂ ਸਮੇਂ ਦੇ ਮੁਤਾਬਕ ਉਸ ਦਿਨ ਅਲੈਕਸ਼ਨ ਵਾਲੇ ਚੋਣ ਬੂਥਾਂ ਦੇ ਲੱਗਦੀਆਂ ਹਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਰਾਤ ਘਰੋਂ ਬਾਹਰ ਰਹਿ ਕੇ ਉਸ ਰਾਤ ਸਾਰੀ ਹੀ ਤਿਆਰੀ ਕਰਨੀ ਤਾਂ ਕਿ ਸਵੇਰੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਚੋਣਾਂ ਕਰਵਾਈਆਂ ਜਾ ਸਕਣ ਇਸ ਤਰ੍ਹਾਂ ਸਾਨੂੰ ਘਰੋਂ ਸਵੇਰੇ ਪਹਿਲੇ ਦਿਨ ਤੜਕੇ ਜਾਣਾ ਪੈਂਦਾ ਹੈ ਉੱਥੇ ਜਾ ਕੇ ਤਾਂ ਸਭ ਤੋਂ ਪਹਿਲਾਂ ਆਪਣੇ ਆਪਣੇ ਇਹ ਬੂਥਾਂ ਦੀਆਂ ਆਪਣੇ ਆਪਣੇ ਕਰਮਚਾਰੀਆਂ ਦੇ ਮੁਤਾਬਕ ਆਪਣੇ ਆਪਣੇ ਲਿਸਟਾਂ ਦੇ ਮੁਤਾਬਕ ਹਾਜ਼ਰੀ ਲ ਲਾਉਣ ਦਾ ਤਰੀਕਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵੱਲੋਂ ਤਾਂ ਬੜਾ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਹੁੰਦਾ ਹੈ ਖਾਣ ਪੀਣ ਦਾ ਚਾਹ ਪਾਣੀ ਦਾ ਆਦਿ ਪਰ ਇੰਨੀ ਦੁਨੀਆਂ ਦੇ ਵਿੱਚ ਇੰਨੇ ਕਰਮਚਾਰੀਆਂ ਦੇ ਵਿੱਚ ਕੋਈ ਨਾ ਕੋਈ ਕਮੀ ਦੀ ਆ ਹੀ ਜਾਂਦੀ ਹੈ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਅਸੀਂ ਸਮੇਂ ਦੇ ਮੁਤਾਬਕ ਇਹਨਾਂ ਡਿਊਟੀਆਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਕਰਕੇ ਆਉਂਦੇ ਹਾਂ ਪਰ ਜੋ ਸਾਨੂੰ ਮੁਸ਼ਕਲਾਂ ਆਉਂਦੀਆਂ ਹਨ ਕਦੇ ਇਹ ਸਮੇਂ ਦੇ ਮੁਤਾਬਕ ਕੰਮ ਕਰਵਾ ਕੇ ਸ਼ਾਮ ਨੂੰ ਉਹ ਸਾਰਾ ਇਹ ਦਾਰਮਦਾਰ ਸਾਰੇ ਕਾਗਜ਼ਾਦ ਉੱਥੇ ਜਮ੍ਹਾਂ ਕਰਵਾਉਣੇ ਜਾਂ ਹੋਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਕਿ ਬੜੇ ਹੀ ਵਧੀਆ ਤਰੀਕੇ ਨਾਲ ਅਸੀਂ ਕਰਕੇ ਆਉਂਦੇ ਹਾਂ ਪਰ ਇਹ ਇੱਕ ਵਧੀਆ ਅਤੇ ਸੁਚਾਰੂ ਤਰੀਕਾ ਹੈ ਧੰਨਵਾਦ